ਹੈਲੋ ਸਰ ਤੁਸੀਂ ਓਲਾ ਕੈਬਸ ਤੋਂ ਬੋਲ ਰਹੇ ਹੋ ਸਰ ਮੈਂ ਪਰਸੋਂ ਕੈਬ ਬੁੱਕ ਕੀਤੀ ਸੀ ਤੁਹਾਡੇ ਓਲਾ ਕੈਬਸ ਤੋਂ ਹਾਂਜੀ ਸਰ ਅਤੇ ਮੈਂ ਸਰ ਮਤਲਬ ਕਿ ਜਾਣਾ ਸੀ ਹਾਂਜੀ ਚੰਡੀਗੜ੍ਹ ਪਹੁੰਚਣਾ ਸੀ ਸਰ ਮੈਂ ਹਾਂਜੀ ਛੇ ਤਰੀਕ ਨੂੰ ਅਤੇ ਮੈਂ ਪਹੁੰਚਣਾ ਸਰ ਅੱਠ ਵਜੇ ਪਹੁੰਚਣਾ ਤਕਰੀਬਨ ਅਤੇ ਤੁਸੀਂ ਸਰ ਮੈਨੂੰ ਦੱਸੋ ਕਿ ਤੁਸੀਂ ਕਿੰਨੇ ਵਜੇ ਪਹੁੰਚ ਜਾਓਗੇ ਸਰ ਮੇਰਾ ਘਰ ਟੂ ਏਟੀ ਨਾਈਨ ਹੈ ਹਾਂਜੀ ਫੇਸ ਵਨ ਬੀ ਅਤੇ ਤੁਸੀਂ ਮਤਲਬ ਕੀ ਮੈਂ ਰੋਡ 'ਤੇ ਹੀ ਆਵਾਂ ਕਿ ਤੁਸੀਂ ਸਰ ਵੀ ਮੇਰੇ ਘਰ ਬ ਆ ਜਾਓਗੇ ਹਾਂਜੀ ਸਰ ਮੈਨੂੰ ਐਵੇਂ ਸੀ ਜੀ ਆਪਾਂ ਟਾਈਮ 'ਤੇ ਪਹੁੰਚ ਜਾਈਏ ਹਾਂਜੀ ਕਿ ਮੇਰਾ ਪਹੁੰਚਣਾ ਜਰੂਰੀ ਹੈ ਸਰ ਜੀ ਜੀ ਜੀ ਮੈਂ ਏਅਰਪੋਰਟ ਐਂਟਰ ਕਰਨਾ ਸਰ ਅੱਠ ਵਜੇ ਤਕਰੀਬਨ ਜੇ ਮੈਨੂੰ ਐਵੇਂ ਸੀ ਵੀ ਆਪਾਂ ਪਹਿਲਾਂ ਤੁਰੀਏ ਵੀ ਆਪਾਂ ਚਾਹ ਵਗੈਰਾ ਵੀ ਪੀ ਪੀ ਲਵਾਂਗੇ ਰਾਹ 'ਚ ਕਿਤੇ ਹਾਂਜੀ ਹਾਂਜੀ ਜੀ ਫਿਰ ਆਪਾਂ ਵੀ ਆਰਾਮ ਨਾਲ ਗੱਡੀ 'ਚ ਜਾਵਾਂਗੇ ਗੱਲਾਂ ਬਾਤਾਂ ਕਰਦੇ ਹਾਂਜੀ ਇਹਦੇ ਨਾਲ ਵੀ ਆਪਣਾ ਵਧੀਆ ਟਾਈਮ ਪਾਸ ਹੋਜੂ ਸਰ ਜੀ ਅਤੇ ਤੁਸੀਂ ਸਰ ਚਲੋ ਟਾਈਮ 'ਤੇ ਆ ਜਾਇਓ ਅਤੇ ਮਿਲਦੇ ਆ ਸਰ ਫਿਰ ਪਰਸੋਂ ਨੂੰ ਸਵੇਰੇ ਛੇ ਵਜੇ ਜੀ